ਭਾਰਤ ਨੌਕਰੀ ਬਜ਼ਾਰ ਬਹੁਤ ਗਿਰਾਵਟ ਵਿੱਚ ਜਾ ਰਿਹਾ ਹੈ ਅਤੇ ਇਸ ਦਾ ਸਾਹਮਣਾ ਕਰ ਰਹੀਆਂ ਮੌਜੂਦਾ ਚੁਣੌਤੀਆਂ ਅੱਜ ਦੀਆਂ ਯੂਵਾ ਪੀੜ੍ਹੀਆਂ ਹਨ ਭਾਵ ਕਿ ਪੜ੍ਹੇ ਲਿਖੇ ਹੋਣ ਦੇ 'ਤੇ ਵੀ ਬਹੁਤ ਘੱਟ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਹਨ ਜੇ ਨੌਕਰੀਆਂ ਮਿਲਦੀਆਂ ਵੀ ਹਨ ਤਾਂ ਅਮੀਰ ਲੋਕ ਰਿਸ਼ਵਤ ਦੇ ਕੇ ਉਹ ਨੌਕਰੀਆਂ ਨੂੰ ਹਾਸਲ ਕਰ ਲੈਂਦੇ ਹਨ ਕਈ ਲੋਕ ਆਪਣਾ ਆਪਣੀਆਂ ਨੌਕਰੀਆਂ ਦੇ ਲਈ ਆਪਣਾ ਘਰ ਬਾਰ ਛੱਡ ਕੇ ਵਿਦੇਸ਼ ਵਿੱਚ ਜਾ ਰਹੇ ਹਨ ਅਤੇ ਸ਼ਹਿਰਾਂ ਵਿੱਚ ਜਾ ਰਹੇ ਹਨ ਜਿਸ ਨਾਲ ਭਾਰਤ ਦੀ ਨੌਕਰੀ ਬਹੁਤ ਗਿਰਾਵਟ ਵਿੱਚ ਹੈ ਇਸ ਦੇ ਮੌਕੇ ਹਨ ਕਿ ਲੋਕਾਂ ਨੂੰ ਵੱਧ ਤੋਂ ਵੱਧ ਪੜ੍ਹੇ ਲਿਖੇ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਨਾਲ ਹੀ ਅਮੀਰ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਲੋਕ ਨੌਕਰੀਆਂ ਨੂੰ ਹਾਸਲ ਕਰ ਸਕਦੇ ਹਨ ਧੰਨਵਾਦ